ਸਰੀਰਕ ਕਸਰਤਾਂ ਅਤੇ ਯੋਗਾ ਦੋਵੇਂ ਇੱਕੋ ਤਰ੍ਹਾਂ ਦੀਆਂ ਸਥਿਤੀਆਂ ਹਨ ਜਿਸ ਦੇ ਵਿੱਚ ਲੋਕ ਇੱਕੋ ਤਰੀਕੇ ਦਾ ਕੰਮ ਕਰਦੇ ਹਨ ਉਹ ਸਰੀਰ ਨੂੰ ਲਚਕੀਲਾ ਬਣਾਉਂਦੇ ਹਨ ਜਿਸ ਦੇ ਰਾਹੀਂ ਸਰੀਰ ਕਾਫ਼ੀ ਫਲੈਕਸੀਵਲ ਹੋ ਜਾਂਦਾ ਹੈ ਕਸਰਤਾਂ ਕਰਨ ਨਾਲ ਅ ਸਰੀਰ ਵਧੀਆ ਰਹਿੰਦਾ ਹੈ ਤੰਦਰੁਸਤ ਰਹਿੰਦਾ ਹੈ ਅਤੇ ਯੋਗਾ ਕਰਨ ਨਾਲ ਵੀ ਸੇਮ ਹੁੰਦਾ ਹੈ ਇਹ ਇੱਕ ਦੂਜੇ ਤੋਂ ਵੱਖ ਨਹੀਂ ਹਨ ਇਹ ਸਿਰਫ਼ ਲੋਕਾਂ ਦਾ ਵਹਿਮ ਹੈ ਕਿ ਇਹ ਵੱਖ ਹੈ ਪਰ ਦੋਨਾਂ ਦਾ ਅ ਨਤੀਜਾ ਇੱਕ ਹੀ ਹੈ ਕਿ ਇਹ ਸਿਰਫ਼ ਸਰੀਰ ਨੂੰ ਤੰਦਰੁਸਤ ਰੱਖਣ ਲਈ ਕੰਮ ਆਉਂਦੀਆਂ ਹਨ